ਟਕਲਜੋ ਟਕਨੋਲਜੀ ਨਾਲ ਸਾਡੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਸੰਚਾਰ ਵਧੀਆ ਤਰੀਕੇ ਨਾਲ ਹੋਣ ਲੱਗ ਪਿਆ ਹੈ ਹੈ ਜਿਵੇਂ ਕਿ ਪਹਿਲੇ ਸਮਿਆਂ ਵਿੱਚ ਲੋਕ ਇੱਕ ਦੂਜੇ ਨੂੰ ਚਿੱਠੀਆਂ ਪਾਉਂਦੇ ਹੁੰਦੇ ਸੀ ਅਤੇ ਉਹ ਚਿੱਠੀ ਕਈ ਵਾਰ ਪੰਦਰ੍ਹਾਂ ਵੀਹ ਦਿਨ ਬਾਅਦ ਪੁੱਜਦੀ ਸੀ ਇਹਦੇ ਨਾਲ ਲੋਕਾਂ ਵਿੱਚ ਬਹੁਤਾ ਆਪਸੀ ਤਾਲਮੇਲ ਘੱਟ ਘੱਟ ਸੀ ਇਸ ਲਈ ਤਕਨੋਲਜੀ ਦੇ ਨਾਲ ਅਜੇ ਮੋਬਾਇਲ ਫੋਨ ਆ ਗਏ ਜਿਵੇਂ ਸੋਸ਼ਲ ਮੀਡੀਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਤਰੱਕੀ ਹੋਈ ਹੈ ਅਤੇ ਅਸੀਂ ਕਿਤੇ ਵੀ ਦੂਰ ਬੈਠੇ ਹੋਏ ਆਪਣੇ ਕਿਸੇ ਸ ਖ਼ਾਸ ਯਾਰ ਮਿੱਤਰ ਜਾਂ ਦੋਸਤ ਜਾਂ ਪਰਿਵਾਰ ਨਾਲ ਜਦੋਂ ਵੀ ਸਾਨੂੰ ਕੋਈ ਕਿਸੇ ਦੀ ਯਾਦ ਆਉਂਦੀ ਹੈ ਤਾਂ ਉਹਦੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਤਕਨੋਲਜੀ ਨੇ ਸਾਨੂੰ ਬਹੁਤ ਜ਼ਿਆਦਾ ਅਸਾਨ ਕਰ ਦਿੱਤਾ ਹੈ ਸਾਡੀ ਜ਼ਿੰਦਗੀ ਨੂੰ ਤਕਨੋਲ ਜਿੱਥੇ ਤਕਨੋਲਜੀ ਨਾਲ ਰਿਸ਼ਤੇ ਮਜ਼ਬੂਤ ਹੋਏ ਹਨ ਉੱਥੇ ਹੀ ਇਹਨਾਂ ਨੂੰ ਥੋੜ੍ਹਾ ਕਮਜ਼ੋਰ ਵੀ ਹੋਏ ਹਨ ਜਿਵੇਂ ਕਿ ਅਸੀਂ ਹਰੇਕ ਬੰਦੇ ਨਾਲ ਰਲ ਮਿਲ ਕੇ ਰਹਿੰਦੇ ਸੀ ਪਰ ਅੱਜ ਆਪ ਆਹੀ ਮੋਬੈਲ ਫੋਨ 'ਤੇ ਲੱਗੇ ਰਹਿੰਦੇ ਆ ਜਿਹਦੇ ਨਾਲ ਸਾਨੂੰ ਬਹੁਤ ਇੱਕ ਦੂਜੇ ਨਾਲ ਘੁੱਲ ਮਿਲ ਜਾਣ ਦਾ ਮੌਕਾ ਘੱਟ ਮਿਲਦਾ ਹੈ ਅਗਰ ਜ ਜੇ ਜਦੋਂ ਟਕਨੋਲਜੀ ਨਹੀਂ ਹੁੰਦੀ ਸੀ ਤਾਂ ਅਸੀਂ ਇਕੱਠੇ ਖੇਡਦੇ ਹੁੰਦੇ ਸੀ ਜਾਂ ਇੱਕ ਦੂਜੇ ਕੋਲ ਬੈਠ ਕੇ ਗ ਗੱਲਾਂ ਕਰਦੇ ਰਹਿੰਦੇ ਸੀ ਇਹਦੇ ਨਾਲ ਸਾਡਾ ਵਧੀਆ ਟੈਮ ਪਾਸ ਹੋ ਜਾਂਦਾ ਸੀ ਪਰ ਅੱਜ ਦੇ ਟੈਮ ਵਿੱਚ ਟਕਨੋਲਜੀ ਦੇ ਆਉਣ ਨਾਲ ਹਰੇਕ ਬੰਦਾ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਬੀਜੀ ਹੋ ਗਿਆ ਹੈ ਜਿਹਦੇ ਨਾਲ ਜਿਸ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਨ ਦਾ ਟੈਮ ਬਹੁਤ ਘੱਟ ਗਿਆ ਹੈ ਹਰੇਕ ਬੰਦਾ ਆਪਣੇ ਕੰਮਾਂ ਕਾਰਾਂ ਵਿੱਚ ਆਪਣੇ ਕੰਮ ਪ੍ਰਤੀ ਬਹੁਤ ਹੀ ਬੀਜੀ ਰਹਿੰਦਾ ਹੈ ਜਾਂ ਵਿਅਸਤ ਰਹਿੰਦਾ ਹੈ ਇਹਦੇ ਨਾਲ ਰਿਸ਼ਤੇ ਵਿੱਚ ਬਹੁਤ ਫਿੱਕ ਫਿੱਕਾ ਫਿੱਕ ਪੈ ਗਈ ਹੈ ਅਤੇ ਰਿਸ਼ਤੇ ਕਮਜ਼ੋਰ ਹੋਏ ਹਨ